ਮੈਂ ਫ਼ਰੀਦਕੋਟ ਸ਼ਹਿਰ ਵਿੱਚ ਰਹਿੰਦੀ ਹਾਂ ਇਹ ਪੰਜਾਬੀ ਖੇਤਰ ਵਿੱਚ ਹੀ ਆਉਂਦਾ ਹੈ ਜੀ ਕਿ ਬਾਬਾ ਫਰੀਦ ਜੀ ਦੀ ਨਗਰੀ ਹੈ ਇੱਥੇ ਹਰ ਸਾਲ ਬਾਬਾ ਫਰੀਦ ਜੀ ਦੇ ਜਨਮ ਉਤਸਵ 'ਤੇ ਇਹ ਮੇਲਾ ਲੱਗਦਾ ਜਿਹੜਾ ਕਿ ਚਾਰ ਪੰਜ ਦਿਨ ਦਾ ਹੁੰਦਾ ਇਸ ਮੇਲੇ ਵਿੱਚ ਆਪਾਂ ਕਈ ਸਾਰੀਆਂ ਮਤਲਬ ਕਿ ਕਲਾ ਦਾ ਪ੍ਰਦਰਸ਼ਨ ਹੁੰਦਾ ਹੈ ਇੱਥੇ ਜਿਵੇਂ ਕਿ ਕਈ ਲੋਕ ਇੱਥੇ ਗੱਤਕਾ ਖੇਡਦੇ ਹਨ ਜਿਹੜੇ ਕਿ ਗੱਤਕਾ ਵਿੱਚ ਬਹੁਤ ਹੀ ਨਿਪੁੰਨ ਹੁੰਦੇ ਹਨ ਗੱਤਕਾ ਖੇਡ ਦਿਖਾਉਣ ਨਾਲ ਕਈ ਮਤਲਬ ਕਿ ਬੱਚਿਆਂ ਦੇ ਵਿੱਚ ਸਿੱਖ ਇਤਿਹਾਸ ਨਾਲ ਜੁੜੇ ਰਹਿਣ ਦੀ ਭਾਵਨਾ ਆਉਂਦੀ ਹੈ ਕਿ ਕਿਸ ਤਰ੍ਹਾਂ ਗੱਤਕਾ ਖੇਡ ਸਿੱਖੀ ਇਤਿਹਾਸ ਵਿੱਚ ਬਹੁਤ ਮਹੱਤਵ ਰੱਖਦੀ ਆ ਉਸ ਤਰ੍ਹਾਂ ਮਤਲਬ ਕਿ ਇੱਥੇ ਸਾਡੇ ਇੱਥੇ ਪੰਜਾਬ ਵਿੱਚ ਕਈ ਕਾਲਜਾਂ ਵਿੱਚ ਯੂਥ ਫੈਸਟੀਵਲ ਵੀ ਹੁੰਦਾ ਯੂਥ ਫੈਸਟੀਵਲ ਵਿਚ ਕਈ ਤਰ੍ਹਾਂ ਦੀ ਕਲਾ ਪ੍ਰਦਰਸ਼ਨ ਹੁੰਦੀ ਹੈ ਜਿਸ ਤਰ੍ਹਾਂ ਕਿ ਕਈ ਮਹਿੰਦੀ ਲਗਾਉਣ ਦੀਆਂ ਕਲਾ ਪ੍ਰਤੀਯੋਗਤਾ ਵੀ ਹੁੰਦੀ ਹੈ ਪੱਗ ਬੰਨਣ ਦੀ ਇਹ ਕਲਾ ਪ੍ਰਤੀਯੋਗਤਾ ਅਤੇ ਹੋਰ ਜਿਵੇਂ ਕਿ ਇਸ ਤਰ੍ਹਾਂ ਫੁਲਕਾਰੀ ਦੀ ਕਢਾਈ ਕਰਨੀ ਇਸ ਤਰ੍ਹਾਂ ਦੇ ਕਲਾ ਪ੍ਰਤੀਯੋਗਤਾ ਹੁੰਦੀ ਹੈ ਜਿਸ ਵਿੱਚ ਕਿ ਬੱਚਾ ਪੰਜਾਬੀ ਸੱਭਿਆਚਾਰ ਦੇ ਪੰਜਾਬੀ ਸੱਭਿਆਚਾਰ ਦੀ ਕਲਾ ਨਾਲ ਜੁੜੇ ਰਹਿੰਦਾ ਹੈ ਇਸ ਤਰ੍ਹਾਂ ਉਸ ਵਿੱਚ ਹੋਰ ਵੀ ਮਤਲਬ ਕਿ ਗੁਣ ਹੁੰਦੇ ਆ ਜਿਵੇਂ ਕਿ ਫੁਲਕਾਰੀ ਦੀ ਕਢਾਈ ਕਰਨ ਲਈ ਸੂਈ ਚਲਾਉਣਾ ਵੀ ਆਉਣਾ ਚਾਹੀਦਾ ਹੈ ਇਸ ਤਰ੍ਹਾਂ ਹੋਰ ਜਿਵੇਂ ਸੰਗੀਤ ਕਲਾ ਇੱਥੇ ਕਈ ਤਿਉਹਾਰ ਅਤੇ ਮੇਲੇ ਮਨਾਏ ਜਾਂਦੇ ਹਨ ਜਿਸ ਤਰ੍ਹਾਂ ਕਿ ਹੋਲਾ ਮਹੱਲਾ ਵੀ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਹੋਲਾ ਮਹੱਲਾ ਅਤੇ ਵਿਸਾਖੀ ਵਿਸਾਖੀ ਦੇ ਤਿਉਹਾਰ ਦੀ ਵੀ ਬਹੁਤ ਮਹੱਤਤਾ ਮਹੱਤਤਾ ਹੈ ਕਿਉਂਕਿ ਇੱਥੇ ਜਿਹੜੇ ਸਿੱਖਾਂ ਦੇ ਦਸਵੇਂ ਗੁਰੂ ਸੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਇਸ ਦਿਨ ਮਤਲਬ ਕਿ ਇਹ ਪੰਜ ਪਿਆਰਿਆਂ ਦੇ ਨਾਮ ਰੱਖੇ ਸੀਗੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਇੱਥੇ ਕਾਲਜ 'ਚ ਯੂਥ ਫੈਸਟੀਵਲ ਵੀ ਤਾਂ ਹੀ ਮਨਾਏ ਜਾਂਦੇ ਤਾਂ ਕਿ ਜਿਹੜੇ ਬੱਚੇ ਹਨ ਨੌਜਵਾਨ ਹਨ ਉਹ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਅਤੇ ਉਹਨਾਂ ਵਿੱਚ ਅਲੱਗ ਅਲੱਗ ਕਲਾ ਪੈਦਾ ਹੋਵੇ ਅਤੇ ਉਹ ਜਿਵੇਂ ਕਿ ਉੱਥੇ ਮਹਿੰਦੀ ਲਗਾਉਣਾ ਸਿਖਾਉਂਦੇ ਹਨ ਅਤੇ ਹੋਰ ਵੀ ਕਲੇ ਆਰਟ ਵਗੈਰਾ ਵੀ ਸਿਖਾਉਂਦੇ ਹਨ ਜਿਸ ਕਰਕੇ ਉਹਨਾਂ ਵਿੱਚ ਅਲੱਗ ਅਲੱਗ ਟੈਲੈਂਟ ਆਉਂਦਾ ਹੈ ਅਤੇ ਉਹ ਆਪਣੇ ਟੈਲੈਂਟ ਨੂੰ ਖੋਲ੍ਹ ਕੇ ਸਾਰੇ ਸਾਹਮਣੇ ਦਰਸ਼ਾ ਸਕਦੇ ਹਨ ਇਸ ਤਰ੍ਹਾਂ ਅਲੱਗ ਅਲੱਗ ਕਲਾ ਦਾ ਆਪਣਾ ਅਲੱਗ ਅਲੱਗ ਸਥਾਨ ਹੁੰਦਾ ਹੈ ਧੰਨਵਾਦ